ਮੈਨੂੰ ਇੱਦਾਂ ਲੱਗਦਾ ਕਿ ਖਾਣਾ ਬਣਾਉਣਾ ਸਿਰਫ ਔਰਤਾਂ ਦਾ ਕੰਮ ਨਹੀਂ ਹੈ ਜੇ ਤੁਸੀਂ ਵਰਲਡ ਦੇ ਰਿਨਾਊਨਡ ਮਤਲਬ ਬਹੁਤ ਪ੍ਰਸਿੱਧ ਉਹਨਾਂ ਨੂੰ ਦੇਖੋ ਕੁਕਿੰਗ ਵਾਲਿਆਂ ਨੂੰ ਤਾਂ ਉਹਨਾਂ ਵਿੱਚ ਵੀ ਮਤਲਬ ਜਿਹੜੇ ਨੇ ਬੰਦੇ ਸ਼ਾਮਿਲ ਨੇ ਹੋਰ ਅਸੀਂ ਦੂਰ ਨਾ ਜਾਈਏ ਅਸੀਂ ਸੰਜੀਵ ਕਪੂਰ ਦੀ ਗੱਲ ਕਰੀਏ ਉਹ ਬਹੁਤ ਵਧੀਆ ਕੁਕ ਮੰਨੇ ਜਾਂਦੇ ਨੇ ਅਤੇ ਮੇਰਾ ਇਹ ਮੰਨਣਾ ਹੈ ਕਿ ਇਹ ਸਿਰਫ ਔਰਤਾਂ ਦਾ ਕੰਮ ਨਹੀਂ ਹੈ ਹਾਂ ਸਾਡੇ ਇੰਡੀਅਨ ਕਲਚਰ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਕਿਚਨ 'ਚ ਜਿਹੜਾ ਹੈ ਉਹ ਔਰਤਾਂ ਨੂੰ ਹੀ ਰਹਿਣਾ ਚਾਹੀਦਾ ਵੈ ਲੇਕਿਨ ਇਹ ਸਿਰਫ ਔਰਤਾਂ ਦਾ ਕੰਮ ਨਹੀਂ ਹੈ ਈਵਨ ਜੇ ਮੈਂ ਆਪਣੇ ਘਰ ਦੀ ਗੱਲ ਕਰਾਂ ਜਿਵੇਂ ਉਹ ਗੱਲ ਕਰ ਰਹੇ ਨੇ ਕਿ ਮੇਰੇ ਘਰ 'ਚ ਵੀ ਜਿਹੜੇ ਮਤਲਬ ਮਰਦ ਨੇ ਉਹ ਪ੍ਰੋਪਰ ਖਾਣਾ ਤਾਂ ਨਹੀਂ ਬਣਾਉਂਦੇ ਹਾਂ ਮਤਲਬ ਥੋੜ੍ਹਾ ਬਹੁਤ ਜੇ ਆਪਾਂ ਕਹੀਏ ਅਤੇ ਮਦਦ ਜ਼ਰੂਰ ਕਰ ਦਿੰਦੇ ਨੇ ਕਿ ਜਿਵੇਂ ਉਹ ਥੋੜ੍ਹਾ ਜਿਵੇਂ ਉਹਨਾਂ ਨੇ ਚਾਹ ਬਣਾ ਦਿੱਤੀ ਜਾਂ ਮਤਲਬ ਕੋਫੀ ਬਣਾ ਦਿੱਤੀ ਜਾਂ ਥੋੜ੍ਹਾ ਬਹੁਤ ਇੱਦਾਂ ਦਾ ਕੰਮ ਕਰਦੇ ਨੇ ਜਿਵੇਂ ਆਪਾਂ ਕਹੀਏ ਕਿ ਉਹ ਪ੍ਰੋਪਰ ਕੁਕਿੰਗ ਕਰ ਲੈਂਦੇ ਨੇ ਪ੍ਰੋਪਰ ਖਾਣਾ ਬਣਾ ਲੈਂਦੇ ਨੇ ਅਤੇ ਉਹ ਮਰਦਾਂ ਲਈ ਪੋਸੀਬਲ ਨਹੀਂ ਹੈ ਲੇਕਿਨ ਇਹ ਸਿਰਫ ਔਰਤਾਂ ਤੱਕ ਸੀਮਿਤ ਨਹੀਂ ਆ ਮੈਨੂੰ ਲੱਗਦਾ ਕਿ ਸਾਨੂੰ ਆਉਣ ਵਾਲੀ ਜਨਰੇਸ਼ਨ ਨੂੰ ਆਪਣੀ ਨੂੰ ਜ਼ਰੂਰ ਖਾਣਾ ਬਣਾਉਣਾ ਜਿਹੜਾ ਉਹ ਸਿਖਾਉਣਾ ਚਾਹੀਦਾ ਹੈ ਕਿਉਂਕਿ ਆਪਾਂ ਜੇ ਦੇਖੀਏ ਜਿਹੜੇ ਬੱਚੇ ਇੱਥੋਂ ਦੀ ਫੋਰਨ ਚਲੇ ਜਾਂਦੇ ਨੇ ਕੈਨੇਡਾ ਵਗੈਰਾ ਹੈ ਨਾ ਅਤੇ ਉੱਥੇ ਜਾ ਕੇ ਉਹ ਆਪ ਹੀ ਸਾਰਾ ਕੰਮ ਕਰਦੇ ਨੇ ਆਟਾ ਵੀ ਆਪ ਗੁੰਨਣਾ ਰੋਟੀ ਪਾਣੀ ਸਾਰਾ ਕੁਛ ਆਪ ਕਰਦੇ ਨੇ ਚਾਹੇ ਉਹ ਮੁੰਡਾ ਹੋਵੇ ਚਾਹੇ ਉਹ ਕੁੜੀ ਹੋਵੇ ਸਾਰੇ ਆਪ ਹੀ ਕਰਦੇ ਨੇ ਅਤੇ ਕਿਉਂ ਨਾ ਸਾਨੂੰ ਇੱਥੋਂ ਹੀ ਆਪਣਾ ਸ਼ੁਰੂ ਕਰਨਾ ਚਾਹੀਦਾ ਮਤਲਬ ਸਾਨੂੰ ਆਪਣੇ ਘਰ ਵੀ ਆਪਣੇ ਬੱਚਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਸਿਖਾਉਣੀਆਂ ਚਾਹੀਦੀਆਂ ਮੈਨੂੰ ਲੱਗਦਾ